ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਮੋਨਕਾ ਵੈਡਿੰਗ ਪਲੈਨਰ ਬੋਲ ਦੇ ਹੈ ਮੈਮ ਮੇਰੀ ਨਾ ਮੈਰਿਜ ਹੈ ਉਹਦੇ ਵਾਸਤੇ ਮੈਂ ਪਲੈਨ ਕਰਵਾਉਣਾ ਸੀ ਮੈਮ ਜੇ ਜਿਸ ਤਰ੍ਹਾਂ ਕਿ ਜਦ ਹਲਦੀ ਦਾ ਹੋ ਗਿਆ ਜਾਗੋ ਹੋਗੀ ਅਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਵਿਆਹ ਵਾਲ਼ੇ ਦਿਨ ਦੀ ਪਾ ਵਿਆਹ ਵਾਲ਼ੇ ਦਿਨ ਵਾਸਤੇ ਕਿੰਨਾ ਕੁ ਖਰਚਾ ਆਊਗਾ ਮੈਮ ਢਾਈ ਤਿੰਨ ਲੱਖ ਦਾ ਕਰ ਸਕਦੇ ਆ ਹਾਂਜੀ ਹਾਂਜੀ ਹੁਣ ਬਰਾਤ ਵਾਲ਼ੇ ਦਿਨ ਚਾਹੀਦੇ ਹਾਂਜੀ ਅਤੇ ਮੈਮ ਜਿਸ ਤਰ੍ਹਾਂ ਕਿ ਮੈਮ ਜਿਸ ਤਰ੍ਹਾਂ ਹਲਦੀ ਵਾਲ਼ੇ ਦਿਨ ਤਾਂ ਥੋੜੇ ਜਿਹੇ ਘਰਾਂ ਦੀ ਰੋਟੀ ਬਣਾਉਣੀ ਹੈ ਜਿਦਾ ਦਾਲ਼ ਮੱਖਣੀ ਹੋ ਗਿਆ ਮਟਰ ਪਨੀਰ ਦਹੀਂ ਚੌਲ ਅਤੇ ਫੁਲਕੇ ਉਸ ਦਿਨ ਦਾ ਅਤੇ ਜਾਗੋ ਵਾਲ਼ੇ ਦਿਨ ਦੀ ਰੋਟੀ ਹੈ ਹਾਂਜੀ ਇਸ ਤਰ੍ਹਾਂ ਜਾਗੋ ਵਾਲ਼ੇ ਦਿਨ ਚਿੱਟੇ ਚਣੇ ਹੋਗੇ ਤੰਦੂਰੀ ਫੁਲਕਾ ਹੋ ਗਿਆ ਨਾਲ਼ ਮਿੱਠੇ ਚੌਲ ਹੋਗੇ ਅਤੇ ਨਾਲ਼ ਮਟਰ ਨਾਲ਼ ਸ਼ਾਹੀ ਪਨੀਰ ਕਰਦਾਂਗੇ ਅਤੇ ਉਸ ਤੋਂ ਬਾਅਦ ਜਿੱਦਾਂ ਪਕੌੜੇ ਹੋਗੇ ਬਰਾਤ ਵਾਲ਼ੇ ਦਿਨ ਤਿੰਨ ਚਾਰ ਵਰੈਟੀਆਂ ਦੇ ਪਕੌੜੇ ਪਨੀਰ ਵਾਲ਼ੇ ਗੋਭੀ ਵਾਲ਼ੇ ਪਾਲਕ ਵਾਲ਼ੇ ਅਤੇ ਮਿਕਸ ਅਤੇ ਨਾਲ਼ ਦੋ ਦੋ ਵਰੈਟੀ ਦੀ ਸੋਸ ਬਣਾਵਾਂਗੇ ਬਾਅਦ ਵਿੱਚ ਮਟਰ ਪਨੀਰ ਸ਼ਾਹੀ ਪਨੀਰ ਅਤੇ ਦਾਲ ਦਾਲ ਮੱਖਣੀ ਅਤੇ ਨਾਲ਼ ਚੌਲ ਨਾਲ਼ ਦਾ ਦਹੀਂ ਅਤੇ ਮਿੱਠੇ ਵਿੱਚ ਅਸੀਂ ਆਈਸਕ੍ਰੀਮ ਲੈਣਾ ਪਸੰਦ ਕਰਾਂਗੇ ਅਤੇ ਮੈਮ ਸਾਰਾ ਕਰਕੇ ਅਤੇ ਕਿੰਨਾ ਆਏਗਾ ਸਟੋਲ ਵੀ ਲਗਾਉਣੇ ਆ ਨਾਲ਼ ਜਿਸ ਤਰ੍ਹਾਂ ਗੋਲ ਗੱਪਿਆਂ ਦਾ ਹਾਂਜੀ ਹਾਂਜੀ ਮੈਮ ਤਿੰਨ ਕਰਨੇ ਆ ਜਿਸ ਤਰ੍ਹਾਂ ਇੱਕ ਗੋਲ ਗੱਪਿਆਂ ਦਾ ਇੱਕ ਟਿੱਕੀ ਦਾ ਅਤੇ ਇੱਕ ਨਿਊਡਲ ਦਾ ਠੀਕ ਹੈ ਮੈਮ ਠੀਕ ਹੈ ਅਤੇ ਮੈਰਿਜ ਦੀ ਡੇਟ ਮੈਰਿਜ ਦੀ ਡੇਟ ਬਾਈ ਜਨਵਰੀ ਹੈ ਠੀਕ ਹੈ ਹਾਂਜੀ ਠੀਕ ਹੈ ਮੈਮ ਠੀਕ ਹੈ ਤੁਸੀਂ ਨਾ ਮੈਂ ਨੰਬਰ ਤੁਹਾਡਾ ਮੋਨਿਕਾ ਕੋਲੋਂ ਲਿਆ ਸੀ ਅਤੇ ਤੁਸੀਂ ਨਾ ਮੈਸੇਜ ਕਰ ਇਹ ਨੰਬਰ ਅਤੇ ਆਪਣਾ ਐਡਰੈਸ ਮੈਸੇਜ ਕਰ ਦਿਓ ਫਿਰ ਤੁਹਾਨੂੰ ਅਸੀਂ ਉੱਥੇ ਆਕੇ ਮਿਲਾਂਗੇ ਠੀਕ ਹੈ ਜੀ ਓਕੇ ਮੈਮ ਓਕੇ